ਹਾਂਜੀ ਜੇ ਆਪਾਂ ਗੱਲ ਕਰੀਏ ਪੌਦਿਆਂ ਦੀ ਬੇ ਬਿਹਤਰ ਸਿਹਤ ਲਈ ਤਾਂ ਅਸੀਂ ਸਲਾਹ ਲੈਂਦੇ ਹਾਂ ਜਿਵੇਂ ਕਈ ਵਾਰ ਅਸੀਂ ਟੀ ਵੀ 'ਤੇ ਵੀ ਪ੍ਰੋਗਰਾਮ ਚੱਲਦੇ ਨੇ ਵੀ ਤੁਸੀਂ ਆਪਣੇ ਬਾਗਬਾਨੀ ਨੂੰ ਜਾਂ ਪੌਦਿਆਂ ਨੂੰ ਉਹਨੂੰ ਕਿਵੇਂ ਵਧੀਆ ਤੋਂ ਫਲ ਲੈ ਸਕਦੇ ਹੋ ਜਾਂ ਉਹਦੀ ਸਿਹਤ ਤੁਸੀਂ ਕਿਵੇਂ ਵਧੀਆ ਰੱਖ ਸਕਦੇ ਹੋ ਜਾਂ ਕਈ ਵਾਰ ਯੂਨੀਵਰਸਿਟੀਆਂ ਜਾਂਦੇ ਹਾਂ ਜਿਵੇਂ ਯੂਨੀਵਰਸਿਟੀ ਲੁਧਿਆਣੇ ਆ ਐਗਰੀਕਲਚਰ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਆ ਜਾਂ ਇੱਕ ਮਾਨਸਾ ਦੇ ਨੇੜੇ ਖੋਖਰ ਪਿੰਡ ਆ ਉੱਥੇ ਵੀ ਕ੍ਰਿਸ਼ੀ ਕੇਂਦਰ ਆ ਉਹਨਾਂ ਦੀ ਵੀ ਸਲਾਹ ਲੈਂਦੇ ਰਹਿੰਦੇ ਹਾਂ ਵੀ ਅਸੀਂ ਕਿਸ ਤਰ੍ਹਾਂ ਕਰੀਏ ਜਾਂ ਉਹ ਛੋਟੇ ਮੋਟੇ ਪ੍ਰੋਗਰਾਮ ਵੀ ਉਡੀਕਦੇ ਰਹਿੰਦੇ ਨੇ ਜਿਹਦੇ ਵਿੱਚ ਉਹ ਦੱਸਦੇ ਰਹਿੰਦੇ ਨੇ ਵੀ ਤੁਸੀਂ ਕਿਹੜੇ ਸਮੇਂ 'ਤੇ ਕਿਹੜੀ ਇਹਨਾਂ ਨੂੰ ਕੰਟਰੋਲ ਕਰਨਾ ਕਿਹੜੀ ਦਵਾਈ ਦੇਣੀ ਆ ਕੇ ਕਿਹੜੀ ਦਵਾਈ ਲਗਾਉਣੀ ਆ ਇਹਨਾਂ ਦੇ ਵਿੱਚ ਜਾਂ ਕਿਵੇਂ ਗੋਡੀ ਕਰਨੀ ਇਹਨਾਂ ਨੂੰ ਜਾਂ ਕਿਵੇਂ ਨਵੀਂ ਬਿਮਾਰੀ ਤੋਂ ਕਿਵੇਂ ਬਚਾਉਣਾ ਉਹ ਸਾਰੀਆਂ ਇਹਨਾਂ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਦੱਸਿਆ ਜਾਂਦਾ ਕੈਂਪ ਲਗਾ ਕੇ ਜਾਂ ਕਈ ਵਾਰ ਜੋ ਲੋਕਲ ਵੀ ਆਉਂਦੇ ਨੇਗੇ ਜਿਹੜੇ ਬਾਗਵਾਨੀ ਵਗੈਰਾ ਨੇ ਉਹਨਾਂ ਤੋਂ ਹੀ ਪੁੱਛ ਲੈਂਦੇ ਹਾਂ ਵੀ ਆਪਣੇ ਭਾਈ ਬੂਟਿਆਂ ਨੂੰ ਇਸ ਤਰ੍ਹਾਂ ਦੀ ਬਿਮਾਰੀ ਲੱਗੀ ਆ ਉਹਨੂੰ ਕਿਵੇਂ ਬਚਾਈਏ ਅਸੀਂ ਤਾਂ ਉਹ ਵੀ ਵਧੀਆ ਬੇਹਤਰ ਜਿਹੜੇ ਲੋਕਲ ਕਿਸਾਨ ਨੇ ਉਹ ਵੀ ਵਧੀਆ ਜਾਣਕਾਰੀ ਦੇ ਦਿੰਦੇ ਨੇ ਵੀ ਇਹਨਾਂ ਵਿੱਚ ਆਹ ਸਪਰੇ ਕਰ ਦਿਓ ਇਸ ਤਰ੍ਹਾਂ ਦੀ ਪਾ ਦਿਓ ਅਤੇ ਹੋਰ ਵੀ ਮਾਲੀ ਵਗੈਰਾ ਜਾਂ ਪੌਦੇ ਲੈ ਕੇ ਆਉਂਦੇ ਨੇ ਉਹਨਾਂ ਤੋਂ ਵੀ ਸਲਾਹ ਲਈ ਜਾਂਦੀ ਆ ਉਹ ਵੀ ਦੱਸ ਦਿੰਦੇ ਨੇ ਕਈ ਵਾਰ ਜਾਂ ਆਪਣੇ ਪੈਸਟੀਸਾਈਡ ਦੀਆਂ ਦੁਕਾਨਾਂ ਹੁੰਦੀਆਂ ਨੇ ਉਹਨੂੰ ਉਹ ਵੀ ਦਵਾਈ ਦੀ ਸਲਾਹ ਦੇ ਕੇ ਦੱਸ ਦਿੰਦੇ ਨੇ ਵੀ ਤਾਂ ਕਰਕੇ ਅਸੀਂ ਪੌਦਿਆਂ ਦੀ ਸਿਹਤ ਨੂੰ ਵਧੀਆ ਸੁਧਾਰ ਸਕਦੇ ਹੈ